ਮੈਂ ਤੈਰਨਾ ਜਾਣਦਾ ਹਾਂ ਮੈਨੂੰ ਤੈਰਨਾ ਬਹੁਤ ਪਸੰਦ ਹੈ ਜੇਕਰ ਕਿਸੇ ਵਿਅਕਤੀ ਨੇ ਤੇੈਰਨਾ ਸਿੱਖਣਾ ਹੋਵੇ ਤਾਂ ਉਸਨੂੰ ਜ਼ਿਆਦਾ ਪਾਣੀ ਵਿੱਚ ਦੌੜਨਾ ਨਹੀਂ ਚਾਹੀਦਾ ਹੈ ਅਤੇ ਉਸਨੂੰ ਆਪਣੀ ਸੇਫਟੀ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਉਹ ਸੇਫਟੀ ਜੈਕਟ ਪਾ ਕੇ ਰੱਖਣੀ ਚਾਹੀਦੀ ਹੈ ਅਤੇ ਜ਼ਿਆਦਾ ਖਾਣਾ ਖਾ ਕੇ ਨਹੀਂ ਤੈਰਨਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਉਸਨੂੰ ਆਪਣੇ ਕੋਲ ਆਕਸੀਜਨ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ ਅਤੇ ਉਸਨੂੰ ਇਹਨਾ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਜ਼ਿਆਦਾ ਪਾਣੀ ਵਿੱਚ ਤੈਰਨਾ ਨਹੀਂ ਚਾਹੀਦਾ ਹੈ